ਅਸੀਂ ਆਪਣੇ ਘਰ ਦੇ ਆਲ਼ੇ ਦੁਆਲ਼ੇ ਸਾਫ਼ ਰੱਖਣ ਲਈ ਬਹੁਤ ਕੰਮ ਕਰਦੇ ਹਨ ਅਸੀਂ ਆਪਣੇ ਲਾਗ ਪਾਸ ਸਾਰੀ ਸਫ਼ਾਈ ਰੱਖਣ ਦਾ ਧਿਆਨ ਦਿੰਦੇ ਹਨ ਅਤੇ ਪੇੜ ਪੌਦੇ ਵੀ ਲਾਉਂਦੇ ਹਨ ਅਤੇ ਹੋਰ ਵੀ ਸਾਰੀਆਂ ਚੀਜ਼ਾਂ ਦਾ ਧਿਆਨ ਦਿੰਦੇ ਹਨ ਅਤੇ ਗੰਦਗੀ ਤੋਂ ਅਸੀਂ ਦੂਰ ਰਹਿ ਕੇ ਖੁਸ਼ ਹਨ ਅਤੇ ਸਾਨੂੰ ਆਪਣਾ ਆਲ਼ਾ ਦੁਆਲਾ ਸਾਰਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਆਲ਼ੇ ਦੁਆਲੇ ਕੋਈ ਲਿਫ਼ਾਫ਼ਾ ਵਗੈਰਾ ਸਾਨੂੰ ਨਹੀਂ ਰ ਛੱਡਣਾ ਚਾਹੀਦਾ ਉਹਨੂੰ ਅੱਛੀ ਤਰ੍ਹਾਂ ਸਾੜ ਦੇਣਾ ਚਾਹੀਦਾ ਹੈ ਉਹ ਉਸਨੂੰ ਡਸਟਬਿਨ ਵਿੱਚ ਵੀ ਡ ਨਾ ਪਾਓ ਕਿਉਂਕਿ ਜ਼ਿਆਦਾ ਗੰਦਗੀ ਫੈਲਦੀਆਂ ਹਨ ਗਾਇਆਂ ਖਾਂਦੀਆਂ ਹਨ ਅਤੇ ਉਹਨਾਂ ਨੂੰ ਵਿਚਾਰੇ ਜਾਨਵਰਾਂ ਨੂੰ ਕੀ ਪਤਾ ਹੈ ਕਿ ਇਹ ਕੀ ਹੈ ਖਾਣ ਵਾਲ਼ੀ ਚੀਜ਼ ਹੈ ਕੀ ਹੈ ਅਤੇ ਸਾਨੂੰ ਆਪਣੇ ਆਪ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਕੋਈ ਕੂੜਾ ਅਸੀਂ ਡਸਟਬਿਨ ਵਿੱਚ ਪਾਉਣ ਵਾਲ਼ਾ ਏ ਉਹੀ ਪਾਉਣਾ ਚਾਹੀਦਾ ਹੈ ਸਾਡੇ ਲਈ ਸਾਰਿਆਂ ਨੂੰ ਸਾ ਇਹ ਕੂੜੇ ਲਈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਫ਼ਾਈ ਦਾ ਬਹੁਤ ਜ਼ਿਆਦਾ ਧਿਆਨ ਕਰਨਾ ਚਾਹੀਦਾ ਹੈ